ਪਠਾਨਕੋਟ ਜਿਹੇ ਸ਼ਹਿਰ ਵਿੱਚ ਮਨੋਰੰਜਨ ਅਤੇ ਖੇਡਾਂ ਜੇ ਵਰਗੀਆਂ ਗਤਵੀਧੀਆਂ ਹਨ ਜਿਹਨਾਂ ਵਿੱਚੋਂ ਕੁਝ ਗਤੀਵਿਧੀਆਂ ਕ੍ਰਿਕਟ ਟੈਨਿਸ ਹੋਕੀ ਬਾਲੀਵੋਲ ਬੈਡਮਿੰਟਨ ਆਦਿ ਹਨ ਇਹਨਾਂ ਗਤਵਿਧੀਆਂ ਨੂੰ ਅੱਜ ਦੇ ਯੂਥ ਵਿੱਚ ਹੋਰ ਮਾਡਰਨ ਜਾਂ ਪ੍ਰਸਿੱਧ ਕਰਨ ਲਈ ਇੱਕ ਮੇਲਾ ਸਥਾਪਿਤ ਕੀਤਾ ਗਿਆ ਦੇਖਿਆ ਗਿਆ ਕਿ ਮੇਲੇ ਵਿੱਚ ਕਾਫੀ ਲੋਕਾਂ ਦਾ ਹੜ ਇਕੱਠਾ ਹੋਇਆ ਲੋਕ ਇਸ ਮੇਲੇ ਨੂੰ ਕਾਫੀ ਹਨ ਅ ਕਾਫੀ ਮਨਾ ਰਹੇ ਸਨ ਦੇਖਿਆ ਗਿਆ ਕਿ ਮੁੰਡੇ ਕੁੜੀਆਂ ਦਾ ਇਹਨਾਂ ਗਤੀਵਿਧੀਆਂ ਅਤੇ ਖੇਡਾਂ ਵੱਲ ਕਾਫੀ ਰੁਝਾਨ ਸੀ ਕ੍ਰਿਕਟ ਵੱਲ ਜ਼ਿਆਦਾ ਮੁੰਡਿਆਂ ਦਾ ਰੁਝਾਨ ਦੇਖਿਆ ਗਿਆ ਅਤੇ ਦੂਜੀ ਤਰਫ ਬੈਡਮਿੰਟਨ ਅਤੇ ਹੋਕੀ ਵੱਲ ਕੁੜੀਆਂ ਦਾ ਕਾਫੀ ਰੁਝਾਨ ਦੇਖਿਆ ਗਿਆ ਦੇਖਿਆ ਗਿਆ ਕਿ ਮੇਲੇ ਵਿੱਚ ਕਾਫੀ ਵੱਡੇ ਵੱਡੇ ਅਤੇ ਪ੍ਰਸਿੱਧ ਖੇਡਕਾਰ ਵੀ ਸ਼ਾਮਿਲ ਹੋਏ ਸਨ ਉਹਨਾਂ ਵੱਲੋਂ ਖਿਡਾਰੀਆਂ ਵਿੱਚ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਮੁਕਾਬਲਾ ਜਿੱਤਣ ਵਾਲੇ ਨੂੰ ਇਨਾਮ ਨਾਲ ਪ੍ਰੋਤਸਾਹਿਤ ਕੀਤਾ ਗਿਆ ਅਤੇ ਦੇਖਿਆ ਗਿਆ ਕਿ ਮੇਲੇ ਵਿੱਚ ਕਾਫੀ ਰੌਣਕ ਦਾ ਮਾਹੌਲ ਸੀ ਮੇਲੇ ਵਿੱਚ ਕਾਫੀ ਹੋਰ ਦੁਕਾਨਾਂ ਵੀ ਸੱਜੀਆਂ ਹੋਈਆਂ ਸਨ ਅਤੇ ਮੇਲਾ ਸੁਬਾ ਅ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਲਿਆ ਜਿਸ ਵਿੱਚ ਹਰ ਇੱਕ ਗਤੀਵਿਧੀ ਦਾ ਮੁਕਾਬਲਾ ਕਰਾਇਆ ਗਿਆ ਮੁਕਾਬਲੇ ਦੇ ਦੌਰਾਨ ਲੋਕ ਕਾਫੀ ਮੇਲੇ ਦਾ ਆਨੰਦ ਆਨੰਦ ਲੈ ਰਹੇ ਸਨ